ਸਾਡੇ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਰੇਲ ਗੱਡੀਆਂ ਚੱਲਦੀਆਂ ਹਨ ਅਤੇ ਹੁਣ ਤਾਂ ਸਾਡੀ ਜਿਹੜੇ ਨਵੇਂ ਪ੍ਰਧਾਨ ਮੰਤਰੀ ਜੀ ਜੇ ਸਾਡੇ ਦੇਸ਼ ਵਿੱਚ ਇੰਡੀਆ ਵਿੱਚ ਚੱਲਣ ਵਾਲੀਆਂ ਸੁਪਰ ਫਾਸਟ ਰੇਲ ਗੱਡੀਆਂ ਵੀ ਲੈ ਆਏ ਹਨ ਇਸਦੀਆਂ ਜਿਹੜੀ ਨਵੀਂ ਆਧੁਨਿਕ ਜਿਹੜੀਆਂ ਸ ਸਾਡੀਆਂ ਟ੍ਰੇਨਾਂ ਹਨ ਉਹਦੀਆਂ ਸੀਟਾਂ ਵੀ ਹਵਾਈ ਜ ਜਹਾਜ਼ ਦੇ ਮੁਤਾਬਿਕ ਹਨ ਉਹਦੇ ਇੰਜਣ ਸੁਪਰ ਫਾਸਟ ਹਨ ਉਹ ਅੱਜ ਕੱਲ੍ਹ ਬਹੁਤ ਹੀ ਘੱਟ ਸ਼ੋਰ ਕਰਦੀਆਂ ਹਨ ਉਹਨਾਂ ਦੇ ਜਿਹੜੇ ਪਹੀਏ ਵੀ ਬਹੁਤ ਸੁੰਦਰ ਅਤੇ ਟਰੈਕ ਵੀ ਜਿਹੜੇ ਆ ਆਧੁਨਿਕ ਬਣਾ ਦਿੱਤੇ ਗਏ ਹਨ ਮੈਂ ਹੁਣੇ ਥੋੜ੍ਹੇ ਦਿਨ ਪਹਿਲਾਂ ਜਲੰਧਰ ਤੋਂ ਦਿੱਲੀ ਦਾ ਯਾਤਰਾ ਕੀਤੀ ਹੈ ਜੋ ਕਿ ਇੱਕ ਸੁਪਰ ਫਾਸਟ ਟਰੇਨ ਸੀਗੀ ਅਤੇ ਜਿਸ ਦਾ ਨਾਮ ਸ਼ਤਾਬਦੀ ਐਕਸਪ੍ਰੈਸ ਹੈ ਸ਼ਤਾਬਦੀ ਐਕਸਪ੍ਰੈਸ ਸਾਢੇ ਪੰਜ ਘੰਟੇ ਵਿੱਚ ਸਾਨੂੰ ਦਿੱਲੀ ਪਹੁੰਚਾ ਦਿੰਦੀ ਇਸ ਵਿੱਚ ਤੁਹਾਨੂੰ ਹਵਾਈ ਜਹਾਜ਼ ਦੀ ਯਾਤਰਾ ਦਾ ਅਨੁਭਵ ਹੀ ਹੁੰਦਾ ਹੈ ਤੁਹਾਨੂੰ ਪਤਾ ਨਹੀਂ ਚੱਲਦਾ ਕਿ ਸਫ਼ਰ ਕਦੋਂ ਖਤਮ ਹੋ ਗਿਆ ਕਿਉਂਕਿ ਇਸ ਦੇ ਵਿੱਚ ਸਫ਼ਰ ਦੇ ਦੌਰਾਨ ਤੁਹਾਨੂੰ ਮਿਲਣ ਵਾਲੀਆਂ ਸੁਵਿਧਾਵਾਂ ਬਹੁਤ ਆਨੰਦਿਤ ਕਰਦੀਆਂ ਉਹ ਲਗਾਤਾਰ ਤੁਹਾਨੂੰ ਰੋਟੀ ਪਾਣੀ ਪਰੋਸਦੇ ਰਹਿੰਦੇ ਹਨ ਚਾਹ ਪਾਣੀ ਪੁੱਛਦੇ ਰਹਿੰਦੇ ਹਨ ਅਤੇ ਟਾਈਮ 'ਤੇ ਟਾਈਮ 'ਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਬੱਚਿਆਂ ਦਾ ਬਹੁਤ ਹੀ ਖ਼ਾਸ ਖਿਆਲ ਰੱਖਿਆ ਜਾਂਦਾ ਹੈ ਧੰਨਵਾਦ